ਮੇਰੀ ਮਨ ਪਸੰਦ ਗੇਮ ਖੋ ਖੋ ਸਕੂਲ ਦੇ ਵਿੱਚ ਮੈਂ ਖੋ ਖੋ ਬੜੀ ਖੇਡਦਾ ਸੀ ਪਹਿਲਾਂ ਮੈਨੂੰ ਕਿਸੇ ਨੇ ਖੋ ਖੋ ਖਿਡਾਇਆ ਨਹੀਂ ਕਿਉਂਕਿ ਮੈਂ ਛੋਟਾ ਲੱਗਦਾ ਹੁੰਦਾ ਸੀ ਏਜ ਦੇ ਵਿੱਚ ਤਾਂ ਮੈਂ ਠੀਕ ਸੀ ਪਰ ਮੇਰੀ ਜਿਹੜਾ ਮੇਰਾ ਕੱਦ ਕਾਠ ਹਾਈਟਸ ਸੀ ਬੜੀ ਸਲੋ ਛੋਟੀ ਸੀ ਮੇਰੀਆਂ ਯਾਦਾਂ ਬੜੀਆਂ ਜੁੜੀਆਂ ਮੈਂ ਜਦੋਂ ਖੋ ਖੋ ਦੇ ਵਿੱਚ ਸਲੈਕਟ ਹੋਇਆ ਛੋਟੀ ਕਲਾਸ ਦੇ ਵਿੱਚ ਮੈਂ ਸਲੈਕਟ ਹੋਇਆ ਅਤੇ ਪਰ ਮੈਂ ਵੱਡੀ ਕਲਾਸ ਦਾ ਕੈਪਟਨ ਬਣਿਆ ਮੈਨੂੰ ਉਹ ਹਜੇ ਵੀ ਯਾਦ ਆ ਮੈਨੂੰ ਐਂ ਕਹਿੰਦੇ ਸੀ ਵੀ ਤੂੰ ਕੀ ਕਰੇਂਗਾ ਤੂੰ ਕੁਛ ਨਹੀਂ ਕਰ ਸਕਦਾ ਉਹ ਗੇਮਾਂ ਦੇ ਨਾਲ ਖੋ ਖੋ ਗੇਮ ਦੇ ਨਾਲ ਮੈਂ ਜ਼ਿਲ੍ਹਾ ਖੇਡਿਆ ਮੇਰੇ ਨੰਬਰ ਵਧੀਆ ਆਉਂਦੇ ਰਹੇ ਪੜ੍ਹਦਾ ਵੀ ਰਿਹਾ ਨਾਲ ਮੈਂ ਖੇਡਦਾ ਵੀ ਰਿਹਾ ਸਾਰਿਆਂ ਨਾਲੋਂ ਮੇਰੀ ਵਧੀਆ ਯਾਦ ਹੈਗੀ ਹੈ ਖੋ ਖੋ ਇਸ ਗੇਮ ਦੇ ਨਾਲ ਹੀ ਮੇਰੀ ਯਾਦ ਆ